ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਹਾਡੀ ਓਲਾ ਕੈਬ ਬੁੱਕ ਕੀਤੀ ਸੀ ਜਿਸ ਕਾਰਨ ਮੈਨੂੰ ਕੁਝ ਦਿੱਕਤਾਂ ਆਈਆਂ ਹੈਗੀਆਂ ਜਦ ਮੈਂ ਤੁਹਾਡੀ ਓਲਾ ਕੈਬ ਮੇਰੇ ਕੋਲ ਆਈ ਹੈਗੀ ਹੈ ਤਦ ਮੈਂ ਜਦ ਉਹ 'ਚ ਬੈਠਣ ਲੱਗੀ ਅਤੇ ਉਹਦੀਆਂ ਕਾਫੀ ਸੀਟਾਂ ਫੱਟੀਆਂ ਹੋਈਆਂ ਅਤੇ ਅਜੀਬ ਜਿਹੀ ਸਮੈੱਲ ਆ ਰਹੀ ਸੀ ਬਜ ਐਮਰਜੈਂਸੀ ਜਾਣ ਕਾਰਨ ਮੈਨੂੰ ਓ ਓਲਾ ਕੈਬ ਯੂਸ ਕਰਨੀ ਪਈ ਜਦ ਮੈਂ ਰਸਤੇ 'ਚ ਜਾ ਰਹੀ ਸੀ ਅਤੇ ਓਹ ਕਾਰ ਰਸਤੇ 'ਚ ਪੈਂਚਰ ਹੋ ਗਈ ਓਹਦਾ ਹੋ ਜਿਹੜਾ ਹੋਰਨ ਵੀ ਹੈ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ ਕਿਰਪਾ ਕਰਕੇ ਇਹਦਾ ਅੱਗੇ ਵਜੋਂ ਧਿਆਨ ਰੱਖਿਆ ਜਾਵੇ ਤਾਂ ਕੀ ਕੋਈ ਵੀ ਗਾਹਕ ਪਰੇਸ਼ਾਨ ਨਾ ਹੋ ਸਕੇ ਧੰਨਵਾਦ